ਇਸ ਧਰਤੀ 'ਤੇ ਹਰ ਇਨਸਾਨ ਦੀ ਅਲੱਗ ਅਲੱਗ ਰੁਚੀ ਅਤੇ ਰੁਝਾਨ ਹਨ ਜੋ ਕਿ ਉਸਨੂੰ ਕੁਦਰਤ ਵੱਲੋਂ ਦੇਣ ਹੈ ਇਸ ਤਰ੍ਹਾਂ ਮੇਰੀ ਰੁਚੀ ਬੁਣਾਈ ਹੈ ਅਤੇ ਮੈਂ ਇਸ ਨੂੰ ਬਹੁਤ ਹੀ ਚੰਗੇ ਢੰਗ ਨਾਲ ਕਰਦੀ ਹਾਂ ਬੁਣਾਈ ਦੀਆਂ ਕਿਸਮਾਂ ਜਿਵੇਂ ਕਿ ਕਰੋਸ਼ੀਆ ਸਲਾਈਆਂ ਸ਼ਟਲ ਯੁਪਿੰਨ ਅਤੇ ਹੋਰ ਵੀ ਹਨ ਮੇਰੀ ਰੁਚੀ ਕਰੋਸ਼ੀਆ ਅਤੇ ਸਲਾਈਆਂ ਦੀ ਹੈ ਪਹਿਲੇ ਤਾਂ ਮੇਰਾ ਇਹ ਇੱਕ ਰੁਝਾਨ ਸੀ ਪਰ ਜਦੋਂ ਮੇਰੇ ਬੁਣੇ ਹੋਏ ਸਵੈਟਰ ਦੀ ਪ੍ਰਸ਼ੰਸਾ ਲੋਕਾਂ ਵੱਲੋਂ ਹੋਈ ਤਾਂ ਮੈਂ ਇਸ ਨੂੰ ਵਧਾ ਲਿਆ ਅਤੇ ਕਮਾਈ ਦਾ ਇੱਕ ਸਾਧਨ ਬਣਾ ਲਿਆ ਹੁਣ ਮੇਰੇ ਬੁਣੇ ਹੋਏ ਸਵੈਟਰ ਅਤੇ ਹੋਰ ਕਈ ਚੀਜ਼ਾਂ ਜਿਵੇਂ ਕੀ ਟੋਪੀਆਂ ਜੈਕਟਾਂ ਸਕਾਫ ਆਦਿ ਦੂਰ ਦੂਰ ਤੱਕ ਲੋਕਾਂ ਨੂੰ ਪਸੰਦ ਆਉਂਦੇ ਹਨ ਅਤੇ ਮੈਂ ਇਸ ਨੂੰ ਇੱਕ ਰੁਜ਼ਗਾਰ ਦਾ ਰੂਪ ਦੇ ਦਿੱਤਾ ਹੈ